ਮੇਰੇ ਖਿਆਲ ਨਾਲ ਗੇਮਿੰਗ ਭਵਿੱਖ ਅੱਗੇ ਅੱਗੇ ਬੱਚਿਆਂ ਲਈ ਬਹੁਤ ਵਧੀਆ ਹੋ ਸਕਦਾ ਕਿਉਂਕਿ ਗੇਮਿੰਗ ਵਿੱਚ ਬੱਚੇ ਬਹੁਤ ਜ਼ਿਆਦਾ ਕੁਛ ਕਰ ਸਕਦੇ ਨੇ ਜਿਹੜੇ ਪੜ੍ਹ ਲਿਖ ਨਹੀਂ ਸਕਦੇ ਉਹ ਬਹੁਤ ਜ਼ਿਆਦਾ ਜਾਨੀ ਕਿ ਵਧੀਆ ਕਰ ਸਕਦੇ ਹਨ ਗੇਮਾਂ ਵਿੱਚ ਮੇਰੇ ਖਿਆਲ 'ਚ ਬੱਚੇ ਜਿਹੜੇ ਸਕੂਲ ਵਿੱਚ ਐਜੂਕੇਸ਼ਨ ਵਿੱਚ ਥੋੜ੍ਹੇ ਜਿਹੇ ਕਮਜ਼ੋਰ ਹਨ ਉਹ ਤਾਂ ਬਹੁ ਗੇਮਾਂ ਵਿੱਚ ਬਹੁਤ ਜ਼ਿਆਦਾ ਕਰ ਸਕਦੇ ਹਨ ਅਤੇ ਰੇਸ਼ੀਅਲ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਹਨ ਕਿਉਂਕਿ ਅਲੱਗ ਅਲੱਗ ਗੇਮਾਂ ਹਨ ਕ੍ਰਿਕੇਟ ਫੁੱਟਬੋਲ ਹਾਕੀ ਐਥਲੈਟਿਕ ਵਗੈਰਾ ਦੌੜਾਂ ਇਹ ਬਹੁਤ ਜ਼ਿਆਦਾ ਜਾਨੀ ਕਿ ਵਧੀਆ ਇਹਨਾਂ ਵਿੱਚ ਬੱਚੇ ਕਰ ਸਕਦੇ ਹਨ ਅਤੇ ਬੱਚੇ ਇਹਦੇ ਵਿੱਚ ਬਹੁਤ ਜ਼ਿਆਦਾ ਰੁਚੀ ਰੱਖਦੇ ਹਨ ਇਹਨਾਂ ਵਿੱਚ ਗੌਰਮੈਂਟਾਂ ਸਰਕਾਰਾਂ ਵੀ ਬਹੁਤ ਵਧੀਆ ਕੰਮ ਕਰ ਰਹੀਆਂ ਹਨ ਅਤੇ ਸਰਕਾਰਾਂ ਵੀ ਹਰ ਵਕਤ ਇਹਨਾਂ ਵਿੱਚ ਕੰਮ ਵਿੱਚ ਰੁਚੀ ਕਰ ਰਹੀਆਂ ਹਨ ਅਤੇ ਬੱਚੇ ਵੀ ਹਰ ਵਕਤ ਇਹਨਾਂ ਦੇ ਕੰਮ ਕਰ ਰਹੇ ਹਨ ਅਤੇ ਅਲੱਗ ਅਲੱਗ ਦੇਸ਼ ਅਲੱਗ ਅਲੱਗ ਦੇਸ਼ਾਂ ਵਿੱਚ ਦੇ ਦੇਸ਼ਾਂ ਵਿੱਚ ਜਾਨੀ ਕਿ ਮੈਡਲ ਲਿਆਉਂਦੇ ਹਨ ਅਤੇ ਬਹੁਤ ਜ਼ਿਆਦਾ ਕਈਆਂ ਨੇ ਨਾਂ ਰੌਸ਼ਨ ਵੀ ਕੀਤਾ ਹੈ ਅਤੇ ਹੁਣ ਤਕਰੀਬਨ ਸਾਰੇ ਸਕੂਲਾਂ ਵਿੱਚ ਗੇਮਿੰਗ ਨੂੰ ਪ ਗੇਮਿੰਗ ਨੂੰ ਜ਼ਿਆਦਾ ਉਤਸ਼ਾਹ ਕੀਤਾ ਜਾਂਦਾ ਹੈ ਕਿਉਂਕਿ ਬੱਚਿਆਂ ਦੀ ਰੁਚੀ ਇਹਨਾਂ ਵਿੱਚ ਵੱਧਦੀ ਜਾਂਦੀ ਹੈ ਕਿਉਂਕਿ ਇਹਨਾਂ ਵਿੱਚ ਇੱਕ ਰੁਜ਼ਗਾਰ ਦਾ ਮੌਕਾ ਵੀ ਮਿਲਦਾ ਹੈ ਅਤੇ ਬਹੁਤ ਵਧੀਆ ਆਉਣ ਵਾਲੇ ਭਵਿੱਖ ਵਿੱਚ ਬਹੁਤ ਬੱਚਿਆਂ ਲਈ ਬਹੁਤ ਵਧੀਆ ਹਨ